ਸਰਕਾਰਾਂ ਜਿਹੜੀਆਂ ਗੱਲਾਂ ਨੂੰ ਕਰਕੇ ਸੱਤਾ ਦੇ ਵਿੱਚ ਆਉਂਦੀਆਂ ਨੇ ਹਮੇਸ਼ਾ ਕੋਈ ਵੀ ਸਰਕਾਰ ਹੋਵੇ ਉਹ ਗੱਲਾਂ ਨੂੰ ਅਕਸਰ ਭੁਲਾ ਦਿੰਦੀਆਂ ਨੇ ਸਰਕਾਰਾਂ ਨੂੰ ਆਪਣੀ ਸੱਤਾ ਪਿਆਰੀ ਹੁੰਦੀ ਆ ਕੁਰਸੀ ਪਿਆਰੀ ਹੁੰਦੀ ਆ ਕਿ ਕਿਵੇਂ ਇਸ ਕੁਰਸੀ 'ਤੇ ਲਗਾਤਾਰ ਬੈਠਣਾ ਬਸ ਇੱਧਰ ਧਿਆਨ ਦਿੰਦੀ ਹੈ ਸਰਕਾਰ ਉਹਨੂੰ ਲੋਕਾਂ ਦੀ ਸਿਹਤ ਨਾਲ ਲੋਕਾਂ ਦੀ ਵਿੱਦਿਆ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੁੰਦਾ ਨਾ ਹੀ ਕੋਈ ਚਿੰਤਾ ਹੁੰਦੀ ਆ ਉਹ ਕਹਿਣ ਮਾਤਰ ਹੀ ਹੁੰਦਾ ਬਿਆਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬਿਆਨ ਵੱਡੇ ਵੱਡੇ ਦੇ ਦੇਣੇ ਕਿ ਅਸੀਂ ਵਿੱਦਿਅਕ ਢਾਂਚਾ ਇਵੇਂ ਕਰ ਦਿਆਂਗੇ ਅਸੀਂ ਸਿਹਤ ਦੇ ਨਾਲ ਸੰਬੰਧਿਤ ਐਸੇ ਕਾਰਜ ਕਰਾਂਗੇ ਕਿ ਵੀ ਲੋਕ ਤੰਦਰੁਸਤ ਰਹਿਣਗੇ ਇਹ ਕੇਵਲ ਕਹਿਣ ਮਾਤਰ ਰਹਿੰਦੇ ਨੇ ਸਰਕਾਰਾਂ ਕੀ ਕਰ ਰਹੀਆਂ ਨੇ ਜੇ ਕਰ ਰਹੀਆਂ ਹੋਣ ਤਾਂ ਉਹ ਸਾਨੂੰ ਜ਼ਰੂਰ ਦੱਸਣਾ ਚਾਹੀਦਾ ਲੋਕਾਂ ਦੇ ਵਿੱਚੋਂ ਵੀ ਲੋਕਾਂ ਦਾ ਵਿਦਿਆ ਦਾ ਮਿਆਰ ਵੀ ਉੱਚਾ ਹੋਣਾ ਚਾਹੀਦਾ ਸਿਹਤ ਦੇ ਪੱਖ ਤੋਂ ਵੀ ਉਹ ਤੰਦਰੁਸਤ ਹੋਣੇ ਚਾਹੀਦੇ ਨੇ ਪਰ ਇਕੱਲੇ ਬਿਆਨਾਂ ਤੱਕ ਸੀਮਤ ਰਹਿ ਜਾਂਦਾ ਸੋ ਲੋਕਾਂ ਨੂੰ ਆਪ ਹੀ ਇਸ ਪ੍ਰਤੀ ਚੇਤੰਨ ਹੋਣ ਦੀ ਲੋੜ ਹੈ ਜਾਗਰੂਕ ਹੋਣ ਦੀ ਲੋੜ ਹੈ ਕਿਸੇ ਸੋਹਣੇ ਢੰਗ ਦੇ ਨਾਲ ਇਹ ਆਪਸੀ ਤਾਲਮੇਲ ਕਰਕੇ ਵਿਦਿਆ ਅਤੇ ਸਿਹਤ ਸਬੰਧੀ ਕੁਝ ਐਸੇ ਕਾਰਜ ਲੋਕ ਉਲੀਕਣ ਤੇ ਆਪਸੀ ਤਾਲਮੇਲ ਦੇ ਨਾਲ ਸਹਿਯੋਗ ਦੇ ਨਾਲ ਇਸ ਪ੍ਰਤੀ ਕਾਰਜ ਕੀਤੇ ਜਾਣ ਜ਼ਰੂਰੀ ਨਹੀਂ ਕਿ ਸਾਨੂੰ ਸਰਕਾਰਾਂ ਤੇ ਹੀ ਨਿਰਭਰ ਹੋਣਾ ਪਵੇ ਸਰਕਾਰਾਂ ਤੋਂ ਇਲਾਈਦਾ ਵੀ ਸਾਡੇ ਕੋਲ ਬਹੁਤ ਸਾਰੀ ਸੱਤਾ ਸਮਰੱਥਾ ਹੁੰਦੀ ਹੈ ਅਸੀਂ ਰਲ ਮਿਲ ਕੇ ਵੀ ਅਜਿਹੇ ਕਾਰਜ ਉਲੀਕ ਸਕਦੇ ਹਾਂ